ਬੈਂਕ ਨੂੰ ਲੈ ਕੇ ਮੇਰਾ ਅਨੁਭਵ ਬਹੁਤ ਬੁਰਾ ਹੈ ਕਿਉਂਕਿ ਜਦ ਵੀ ਮੈਂ ਬੈਂਕ 'ਚ ਜਾਂਦਾ ਹਾਂ ਤਾਂ ਉੱਥੇ ਜਿਹੜੇ ਫਾਰਮ ਹੈ ਸਾਰੇ ਅੰਗਰੇਜ਼ੀ ਵਿੱਚ ਛਾਪੇ ਹੋਏ ਹਨ ਜਿਨ੍ਹਾਂ ਨੂੰ ਪੜ੍ਹਨ 'ਚ ਮੈਨੂੰ ਬਹੁਤ ਦਿੱਕਤ ਹੁੰਦੀ ਹੈ ਮੈਨੂੰ ਪੜ੍ਹਨਾ ਆਉਂਦਾ ਨਹੀਂ ਹੈ ਅੰਗਰੇਜ਼ੀ ਇਸ ਕਰਕੇ ਮੈਨੂੰ ਪਹਿਲਾਂ ਕੋਈ ਬੰਦਾ ਲੱਭਣਾ ਪੈਂਦਾ ਹੈ ਜਿਹੜਾ ਅੰਗਰੇਜ਼ੀ ਪੜ੍ਹ ਕੇ ਉਹਨੂੰ ਫਿਰ ਫਾਰਮ ਨੂੰ ਭਰ ਸਕੇ ਜੋ ਕਿ ਬਹੁਤ ਮੁਸ਼ਕਿਲ ਨਾਲ ਲੱਭਦਾ ਹੈ ਫਿਰ ਉਸ ਤੋਂ ਬਾਅਦ ਜਦੋਂ ਮੈਂ ਪੈਸੇ ਕਢਾਉਣ ਜਾਂਦਾ ਹਾਂ ਕੈਸੀਅਰ ਕੋਲ ਜਾਂਦਾ ਹਾਂ ਉੱਥੇ ਬਹੁਤ ਲੰਬੀ ਲਾਈਨ ਹੁੰਦੀ ਹੈ ਜਿਸ ਕਰਕੇ ਸਾਨੂੰ ਖੜ੍ਹਨਾ ਪੈਂਦਾ ਹੈ ਕਿਉਂਕਿ ਉੱਥੇ ਸਟਾਫ ਬਹੁਤ ਘੱਟ ਹੈ ਇਸ ਕਰਕੇ ਉੱਥੇ ਲੰਬੀ ਲਾਈਨ ਲੱਗ ਜਾਂਦੀ ਹੈ ਅਤੇ ਜਦੋਂ ਮੈਂ ਕੈਸ਼ੀਅਰ ਕੋਲ ਪੁੱਜ ਜਾਂਦਾ ਹੈ ਤਾਂ ਕੈਸ਼ੀਅਰ ਨੂੰ ਵੀ ਬੋਲਣ ਦੀ ਤਮੀਜ਼ ਨਹੀਂ ਹੈ ਉਹ ਵੀ ਉਹਨੂੰ ਛੋਟੇ ਨਾਲ ਕਿੱਦਾਂ ਬੋਲਣਾ ਅਤੇ ਬੜਿਆਂ ਨਾਲ ਕਿੱਦਾਂ ਬੋਲਣਾ ਕੋਈ ਤਮੀਜ਼ ਨਹੀਂ ਹੈ ਉਹ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ ਉਹਦਾ ਸੁਭਾਅ ਬਹੁਤ ਮਾੜਾ ਹੈ ਅਤੇ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਫਿਰ ਇੱਦਾਂ ਦੁੱਖ ਹੁੰਦਾ ਹੈ